ਹਾਂਜੀ ਮੈਂ ਫਿਲਮੀ ਅਭਿਨੇਤਰੀ ਤੋਂ ਪ੍ਰਭਾਵਿਤ ਹੋ ਕੇ ਸੂਟ ਦਾ ਡਿਜ਼ਾਇਨ ਕੀਤਾ ਸੀਗਾ ਅਤੇ ਉਹਨੂੰ ਬਣਾਉਣ ਲਈ ਮੁਸ਼ਕਲਾਂ ਆਈਆਂ ਸੀਗੀਆਂ ਕਿ ਜੋ ਉਹ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਸਟੱਫ ਉਹ ਕਲਰ ਨਹੀਂ ਮਿਲਦੇ ਅਤੇ ਇਹ ਕਿਵੇਂ ਮੈਂ ਬਣਾ ਬਣਿਆ ਸੀਗਾ ਅਤੇ ਉਹ ਵੀ ਮੈਂ ਦੱਸਾਂਗੀ ਪਰ ਜਿੱਦਾਂ ਜਦੋਂ ਮੈਂ ਫਿਰ ਸਟੱਫ ਦਾ ਪਤਾ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਉਹ ਸਿਲਕ ਦੇ ਵਿੱਚ ਹੁੰਦੀਆਂ ਸਾਰਾ ਕੱਪੜਾ ਜਿਹੜਾ ਸਿਲਕ 'ਚ ਕਲਰ ਮਿਲਦੇ ਉਹ ਵਾਲੇ ਅਤੇ ਫਿਰ ਮੈਂ ਮਾਰਕੀਟ ਜਾ ਕੇ ਸਿਲਕ ਦਾ ਕੱਪੜਾ ਲਿਆਂਦਾ ਅਤੇ ਫਿਰ ਮੈਂ ਉਹਦੇ ਤੋਂ ਉਹਨੂੰ ਸੂਟ ਨੂੰ ਸੇਮ ਦਾ ਡਿਜ਼ਾਇਨ ਕੀਤਾ ਡਿਜ਼ਾਇਨ ਕਰਨ 'ਚ ਮੁਸ਼ਕਲਾਂ ਥੋੜ੍ਹੀਆਂ ਨੈਕਲਾਈਨ ਨੂੰ ਬਣਾਉਣ ਲੱਗੇ ਮੈਨੂੰ ਮੁਸ਼ਕਿਲ ਆਈ ਕਿਉਂਕਿ ਉਹ ਨੈਕਲਾਈਨ ਜਿਹੜੀ ਸੀਗੀ ਥੋੜ੍ਹਾ ਹਾਈ ਨੈਕ ਸੀਗਾ ਅਤੇ ਮੈਨੂੰ ਹਾਈ ਨੈਕ ਬਣਾਉਣਾ ਨਹੀਂ ਆਉਂਦਾ ਸੀਗਾ ਅਤੇ ਫਿਰ ਮੈਂ ਥੋੜ੍ਹਾ ਯੂਟਿਊਬ ਦੀ ਮਦਦ ਦੇ ਨਾਲ ਮੈਂ ਉਹਨੂੰ ਬਣਾਇਆ ਮਤਲਬ ਅੱਜ ਕੱਲ੍ਹ ਹੈ ਹੈ ਨਾ ਅਤੇ ਉਥੋਂ ਦੇਖ ਕੇ ਫਿਰ ਮੈਂ ਉਹਦਾ ਨੈਕ ਡਿਜ਼ਾਇਨ ਕੀਤਾ ਅਤੇ ਇੰਨਾ ਮਤਲਬ ਕਿ ਸੋਹਣਾ ਬਣਿਆ ਸੀ ਨਾ ਉਹ ਅਤੇ ਮੈਨੂੰ ਕਈਆਂ ਨੇ ਪੁੱਛਿਆ ਵੀ ਤੂੰ ਕਿੱਥੋਂ ਬਣਾਇਆ ਕਿੱਥੋਂ ਬਣਾਇਆ ਫਿਰ ਮੈਨੂੰ ਮਤਲਬ ਉਹਦੇ ਆਰਡਰ ਵੀ ਆਏ ਮੈਂ ਇੱਕ ਆਪਣਾ ਬੁਟੀਕ 'ਤੇ ਕੰਮ ਕਰਦੀ ਸੀਗੀ ਫਿਰ ਮੈਂ ਹੌਲੀ ਹੌਲੀ ਇਹ ਬੁਟੀਕ ਨਾਲ ਉਹ ਡਿਜ਼ਾਇਨ ਨੂੰ ਮੈਂ ਬਣਾ ਕੇ ਅਤੇ ਮੇਰਾ ਉਹ ਡਿਜ਼ਾਇਨ ਬਹੁਤ ਵਿਕਿਆ ਫਿਰ ਕਾਫ਼ੀ ਆਰਡਰ ਆਏ ਮੈਨੂੰ ਉਹਦੇ ਵੀ ਈਵਨ ਕਿ ਮੇਰੀ ਟੀਚਰ ਵੀ ਇੱਕ ਸਕੂਲ ਟੀਚਰ ਮੇਰੇ ਉਹ ਵੀ ਮੈਰੇ ਕੋਲ ਸੂਟ ਬਣਵਾਉਣ ਲਈ ਆਏ ਕਿ ਇੰਨਾ ਸੋਹਣਾ ਇੰਨਾ ਸੋਹਣਾ ਕਲਰ ਬਣਾਇਆ ਤੂੰ ਤਾਂ ਵਧੀਆ ਲੱਗਿਆ ਮੈਨੂੰ ਅੱਜ ਮੇਰਾ ਬਿਜਨਸ ਅੱਛਾ ਚੱਲ ਰਿਹਾ ਉਹਦੇ ਨਾਲ ਹੈਨਾ